ਹੈਲੋ ਸਤਿ ਸ਼੍ਰੀ ਅਕਾਲ ਜੀ

ਹਾਂ ਮੈਂ ਬਰਨਾਲੇ ਸਕੂਲ ਦੇਖਿਆ ਸੀ ਫੀਸ ਵੀ ਠੀਕ ਹੈ ਨੇੜੇ ਵੀ ਹੈ ਪਰ ਪ ਪੜ੍ਹਾਈ ਘੱਟ ਆ ਫਿਰ ਮੈਂ ਧਨੌਲੇ ਵੀ ਦੇਖਿਆ ਸੀ ਫੀਸ ਠੀਕ ਹੈ ਪੜ੍ਹਾਈ ਵੀ ਹੈ ਪਰ ਉਹ ਬਹੁਤ ਦੂਰ ਹੈ ਬੱਚਿਆਂ ਨੂੰ ਜਾਣਾ ਕਰਨਾ ਟਰੈਫਿਕ ਬਹੁਤ ਹੈ ਆਪਣੇ ਮਨ ਡਰਦਾ ਠੀਕ ਹੈ ਅਤੇ ਉਹ ਵੀ ਠੀਕ ਨਹੀਂ ਲੱਗਿਆ ਮੈਨੂੰ ਬੱਚਿਆਂ ਦਾ ਜਾਣਾ ਬਹੁਤ ਔਖਾ ਚਲੋ ਚਲੋ ਕੱਲ੍ਹ ਨੂੰ ਆਪਾਂ ਨਾ ਚਲਦੇ ਐਂਗੇ ਅੱਠ ਕੁ ਵਜੇ ਕੋਈ ਚੰਗਾ ਸਕੂਲ ਦੇਖਾਂਗੇ ਜਿੱਥੇ ਖੇਡਾਂ ਵੀ ਜ਼ਰੂਰ ਹੋਣ ਅਤੇ ਸਟਾਫ ਬਾਰੇ ਵੀ ਆਪਾਂ ਦੇਖਣਾ ਵੀ ਸਟਾਫ ਵਧੀਆ ਪੜ੍ਹਾਈ ਵੀ ਵਧੀਆ ਹੋਵੇ ਬੈਸਟ ਸਕੂਲ ਹੋਵੇ ਸਕੂਲ ਵਧੀਆ ਹੋਵੇ ਬਿਲਡਿੰਗ ਵਗੈਰਾ ਅਤੇ ਸਟਾਫ ਵੀ ਉਹਦਾ ਵਧੀਆ ਹੋਵੇ ਬੈਸਟ ਸਕੂਲ ਦੇਖ ਕੇ ਫਿਰ ਆਪਾਂ ਠੀਕ ਹੈ ਦਸ ਵਜੇ ਦਾ ਰੱਖ ਲਉ ਠੀਕ ਹੈ ਚਲੋ ਮੋਟਰਸਾਇਕਲ 'ਤੇ ਹੋਈ ਚੱਲਾਂਗੇ ਆਪਾਂ ਬੈਸਟ ਸਕੂਲ ਦੇਖਣਾ ਜਿੱਥੇ ਗਰਾਊਂਡ ਵੀ ਵਧੀਆ ਹੋਵੇ ਸਟਾਫ ਵੀ ਵਧੀਆ ਹੋਵੇ ਅਤੇ ਫੀਸ ਵਗੈਰਾ ਵੀ ਠੀਕ ਹੋਵੇ ਜੀ